ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਮ ਹਮ ਹਮ ਹਮ ਹਾਂਜੀ ਹਮ ਹਮ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਸਰ ਅੰਮ੍ਰਿਤਸਰ ਤਕਰੀਬਨ ਢਾਈ ਸੌ ਕਿਲੋਮੀਟਰ ਆ ਪਟਿਆਲੇ ਤੋਂ ਅਤੇ ਹਾਂਜੀ ਇੱਥੋਂ ਮੇਨ ਤਾਂ ਸਰ ਇੱਕ ਟ੍ਰੇਨ ਹੈ ਦਾਦਰ ਐਕਸਪ੍ਰੈਸ ਹੈ ਅਤੇ ਦੂਸਰਾ ਇਹ ਹੈ ਕਿ ਕਿਉਂਕਿ ਜੀਟੀ ਰੋਡ ਤੋਂ ਥੋੜ੍ਹਾ ਜਿਹਾ ਹੱਟ ਕੇ ਹੈ ਤਾਂ ਟ੍ਰੇਨ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ ਉਸ ਤੋਂ ਇਲਾਵਾ ਸਰ ਕਿਉਂਕਿ ਪੀ ਆਰ ਟੀ ਸੀ ਦਾ ਹੈਡ ਆਫਿਸ ਹੈ ਪਟਿਆਲੇ ਦੇ ਵਿੱਚ ਤਾਂ ਤੁਹਾਨੂੰ ਬੱਸਿਸ ਹੈ ਜਿਹੜੀਆਂ ਉਹ ਮਤਲਬ ਫਰੀਕੂਐਂਟ ਬੱਸਿਸ ਆ ਜਿਹੜੀਆਂ ਉਹ ਚਲਦੀਆਂ ਅੰਮ੍ਰਿਤਸਰ ਦੇ ਲਈ ਅਤੇ ਉਹ ਬੱਸ ਵਾਲੀ ਕੁਨੈਕਟੀਵਿਟੀ ਠੀਕ ਹੈ ਕਿਉਂਕਿ ਹਰ ਅੱਧੇ ਘੰਟੇ ਦੇ ਵਿੱਚ ਇੱਕ ਦੋ ਬੱਸਿਸ ਹੈ ਜਿਹੜੀਆਂ ਡਾਇਰੈਕਟ ਅੰਮ੍ਰਿਤਸਰ ਜਾਂਦੀਆਂ ਅਤੇ ਜਾਂ ਫਿਰ ਜੇ ਤੁਸੀਂ ਸਰਹੰਦ ਤੱਕ ਕਿਸੇ ਤਰ੍ਹਾਂ ਪਹੁੰਚ ਜੋ ਜੇ ਮਤਲਬ ਜਲਦੀ ਜਾਣਾ ਤਾਂ ਸਰਹੰਦ ਤੋਂ ਦਿੱਲੀ ਵਾਲੀ ਬੱਸ ਵੀ ਤੁਸੀਂ ਪਕੜ ਸਕਦੇ ਹੋ ਅਤੇ ਹਾਂਜੀ ਹਾਂਜੀ ਰਾਜਪੁਰਾ ਜਾਂ ਸਰਹੰਦ ਤੁਸੀਂ ਆ ਜੋ ਉੱਥੇ ਸਾਰੀਆਂ ਟ੍ਰੇਨਜ਼ ਆ ਜਿਹੜੀਆਂ ਪਿੱਛੋਂ ਆ ਰਹੀਆਂ ਉਹ ਰੁਕ ਕੇ ਜਾਂਦੀਆਂ ਉੱਥੋਂ ਅੰਮ੍ਰਿਤਸਰ ਵੱਲ ਅਤੇ ਉਸ ਹਾਂਜੀ ਹਾਂਜੀ ਹਾਂਜੀ ਸਰ ਪਹਿਲਾਂ ਲੁਧਿਆਣਾ ਆਏਗਾ ਲੁਧਿਆਣੇ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਫਿਰ ਅੰਮ੍ਰਿਤਸਰ ਹਾਂਜੀ ਅਤੇ ਹਾਂਜੀ ਸਰ ਇੱਧਰ ਵੀ ਉੱਦਾਂ ਹੀ ਹੈ ਟ੍ਰੇਨ ਟ੍ਰੇਨਸ ਹੈਗੀਆਂ ਦੋ ਤਿੰਨ ਪਟਿਆਲੇ ਤੋਂ ਕੁਨੈਕਟਿਵਿਟੀ ਹੈ ਅਤੇ ਉਸ ਤੋਂ ਇਲਾਵਾ ਬੱਸਿਸ ਬਿਲਕੁਲ ਫਰੀਕੁਐਂਟ ਚਲਦੀਆਂ ਕਿਉਂਕਿ ਪੀ ਆਰ ਟੀ ਸੀ ਹੈ ਅਤੇ ਬਾਕੀ ਸਰ ਤੁਸੀਂ ਕੈਬ ਵੀ ਲੈ ਸਕਦੇ ਹੋ ਟੈਕਸੀ ਇੱਕ ਸਰਵਿਸ ਵੀ ਹੈ ਇੱਥੇ ਅਤੇ ਉਹ ਥੋੜ੍ਹੀ ਜਿਹੀ ਓਲਾ ਸਰ ਮਤਲਬ ਸ ਵਿਦਇਨ ਸਿਟੀ ਹੈਗੀ ਹੈ ਬਟ ਉਹਦੀ ਫਰੀਕੁਐਂਸੀ ਇੰਨੀ ਜ਼ਿਆਦਾ ਨਹੀਂ ਹੈ ਬਾਹਰ ਦੇ ਲਈ ਤੁਸੀਂ ਕੈਬ ਲੈ ਸਕਦੇ ਹੋ ਵੰਨ ਵੇ ਕੈਬ ਅੰਮ੍ਰਿਤਸਰ ਅਰਾਊਂਡ ਸਰ ਪੈਂਤੀ ਛੱਤੀ ਸੌ ਰੁਪਏ ਵੰਨ ਵੇ ਹੁੰਦਾ ਉਹਦਾ ਤਾਂ ਹਾਂਜੀ ਹਾਂਜੀ ਹਾਂਜੀ ਅਤੇ ਬਾਕੀ ਸਰ ਪੰਜਾਬ ਦੇ ਹਰ ਸ਼ਹਿਰ ਦੇ ਲਈ ਤੁਹਾਨੂੰ ਬੱਸ ਮਿਲ ਜਾਏਗੀ ਕਿਉਂਕਿ ਪੈਪਸੂ ਦਾ ਪੀ ਆਰ ਟੀ ਸੀ ਦਾ ਹੈਡ ਆਫਿਸ ਹੈ ਅਤੇ ਚੰਡੀਗੜ੍ਹ ਦੇ ਲਈ ਫਿਰ ਇੱਥੋਂ ਬੱਸਿਸ ਬਹੁਤ ਜ਼ਿਆਦਾ ਚਲਦੀਆਂ ਹਰ ਦਸ ਪੰਦਰ੍ਹਾਂ ਮਿੰਟ ਬਾਅਦ ਬਸ ਹੈ ਬਟ ਚੰਡੀਗੜ੍ਹ ਦੇ ਨਾਲ ਰੇਲ ਲਾਈਨ ਦੀ ਕੋਈ ਕੁਨੈਕਟਿਵਿਟੀ ਨਹੀਂ ਹੈ ਤਾਂ ਟ੍ਰੇਨ ਕੋਈ ਵੀ ਪਟਿਆਲੇ ਤੋਂ ਚੰਡੀਗੜ੍ਹ ਨਹੀਂ ਜਾਂਦੀ ਬਾਏ ਰੋਡ ਹਾਂਜੀ ਚੰਡੀਗੜ੍ਹ ਵੀ ਪੀ ਆਰ ਟੀ ਸੀ ਦੀਆਂ ਬੱਸਿਸ ਹੈ ਜਿਹੜੀਆਂ ਬਹੁਤ ਜ਼ਿਆਦਾ ਚਲਦੀਆਂ ਹਰ ਪੰਦਰ੍ਹਾਂ ਮਿੰਟ ਬਾਅਦ ਬੱਸ ਹੈ ਦਸ ਪੰਦਰ੍ਹਾਂ ਮਿੰਟ ਬਾਅਦ ਅਤੇ ਦੂਸਰਾ ਸਰ ਆ ਜਿਵੇਂ ਅੱਜ ਕੱਲ੍ਹ ਬਲਾ ਬਲਾ ਵਰਗੀ ਐਪ ਹੈ ਅਤੇ ਉੱਥੋਂ ਵੀ ਤੁਹਾਨੂੰ ਸ਼ੇਅਰਿੰਗ ਬੇਸਿਜ਼ 'ਤੇ ਟੈਕਸਿਜ਼ ਬਹੁਤ ਚਲਦੀਆਂ ਬਹੁਤ ਮਿਲ ਜਾਂਦੀਆਂ ਹਾਂ ਅਤੇ ਚੰਡੀਗੜ੍ਹ ਦੇ ਲਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਕਨੈਕਟੀਵਿਟੀ ਦਾ ਇਸ਼ੂ ਨਹੀਂ ਹੈ ਚੰਡੀਗੜ੍ਹ ਜਿਹੜੀ ਕਨੈਕਟੀਵਿਟੀ ਹੈ ਬਹੁਤ ਫਰੀਕੁਐਂਟ ਆ ਹਾਂਜੀ ਹਾਂਜੀ ਅਤੇ ਸਰ ਹੋਰ ਕੋਈ ਜਾਣਕਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੈਫੀਨੇਟਲੀ ਜੀ ਓਕੇ ਸਰ ਗੁੱਡ ਡੇ ਜੀ ਓਕੇ ਜੀ